ਅੰਮ੍ਰਿਤਸਰ ਜ਼ਿਲ੍ਹੇ ਦਾ ਸੱਭਿਆਚਾਰ ਹੈ ਅੰਬਰਸਰ ਵਿੱਚ ਪ੍ਰਸਿੱਧ ਗਿੱਧਾ ਭੰਗੜਾ ਲੋਕ ਗੀਤ ਇਹ ਸਾਡੇ ਸੰਸਾਰ ਦੇ ਪ੍ਰਸਿੱਧ ਤਿਉਹਾਰ ਹਨ ਰੀਤੀ ਰਿਵਾਜ਼ ਹਨ ਅੰਮ੍ਰਿਤਸਰ ਵਿੱਚ ਕੁਝ ਅਜਿਹੇ ਵੀ ਹਨ ਜਿਨ੍ਹਾਂ ਲੋਕਾਂ ਦਾ ਰਹਿਣ ਸਹਿਣ ਪਹਿਰਾਵਾ ਖਾਣ ਪੀਣ ਗਾਉਣਾ ਵਜਾਉਣਾ ਆਦਿ ਵੀ ਸ਼ਾਮਿਲ ਹੁੰਦਾ ਹੈ ਅੰਮ੍ਰਿਤਸਰ ਪੰਜਾਬ ਦਾ ਖੂਬਸੂਰਤ ਸ਼ਹਿਰ ਹੈ ਅੰਮ੍ਰਿਤਸਰ ਸਿੱਖ ਧਰਮ ਦਾ ਅਧਿਆਤਮਿਕ ਅਤੇ ਸੰਸਕ੍ਰਿਤੀ ਕੇਂਦਰ ਹੈ ਸਾਡੇ ਅੰਮ੍ਰਿਤਸਰ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਲੋਕ ਵਿਸਾਖੀ ਦੇ ਮੇਲੇ ਵੇਖਣ ਆਉਂਦੇ ਹਨ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰਿਆਂ ਕੋਲ ਆਪ ਵੀ ਅੰਮ੍ਰਿਤ ਛਕਿਆ ਅਤੇ ਸਿੱਖ ਧਰਮ ਦੀ ਨੀਂਹ ਰੱਖੀ ਹਰਿਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਸਾਈ ਮੀਆਂ ਮੀਰ ਜੀ ਤੋਂ ਰਖਵਾਈ ਗਈ ਲੋਕ ਬੜੀ ਸ਼ਰਧਾ ਨਾਲ ਅੰਬਰਸਰ ਵਿੱਚ ਦਰਬਾਰ ਸਾਹਿਬ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਨ ਅਤੇ ਆਪਣੀ ਸ਼ਰਧਾ ਨਾਲ ਜੋ ਮਨੋਕਾਮਨਾ ਬਾਬਾ ਜੀ ਕੋ ਪੂਰੀ ਬਾਬਾ ਜੀ ਉਹਨਾਂ ਦੀ ਮਨੋਕਾਮਨਾ ਪੂਰੀ ਕਰਦੇ ਹਨ ਲੋਕ ਬਹੁਤ ਸ਼ਰਧਾ ਨਾਲ ਗੁਰਦੁਆਰੇ ਆਉਂਦੇ ਹਨ ਅਤੇ ਬਾਬਾ ਜੀ ਦੇ ਅੱਗੇ ਆਪਣੇ ਵਿਚਾਰ ਭਾਵਨਾ ਪ੍ਰਗਟ ਕਰਦੇ ਹਨ ਜਿਹੜਾ ਵਿਅਕਤੀ ਅੰਮ੍ਰਿਤ ਛਕਦਾ ਹੈ ਉਹ ਨਿਤਨੇਮ ਅਤੇ ਹੋਰ ਬਾਣੀਆਂ ਆਦਿ ਨੂੰ ਵੀ ਸਰਵਨ ਕਰਦਾ ਹੈ ਇਸ ਤਰ੍ਹਾਂ ਉਹ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਂਦਾ ਹੈ ਦਰਬਾਰ ਸਾਹਿਬ ਵਿੱਚ ਛੋਟੇ ਕੱਪੜੇ ਜਾਂ ਮੋਬਾਈਲ ਫੋਨ ਜਾਂ ਸਲਫੀ ਨਹੀਂ ਖਿੱਚਦੇ ਕਿਉਂਕਿ ਇਹ ਗੁਰਿਆ ਗੁਰੂ ਸਾਹਿਬ ਦੀ ਮਰਿਆਦਾ ਨਹੀਂ ਹੈ ਲੋਕ ਬੜੀ ਸ਼ਰਧਾ ਨਾਲ ਦਰਬਾਰ ਸਾਹਿਬ ਵਿੱਚ ਪਰਿਕਰਮਾ ਅਤੇ ਸਾਫ ਸਫਾਈ ਵਿੱਚ ਆਪਣਾ ਹਿੱਸਾ ਪਾਉਂਦੇ ਹਨ ਅਤੇ ਲੋਕ ਸੇਵਾ ਭਾਵਨਾ ਨਾਲ ਦਾਨ ਪੁੰਨ ਵੀ ਕਰਦੇ ਹਨ ਲੋਕ ਗੁਰੂ ਹਾਜ਼ਰੀ ਵਿੱਚ ਪਾਠ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ ਸਾਡੇ ਸਮਾਜ ਵਿੱਚ ਇਸਤਰੀਆਂ ਦਾ ਪਹਿਰਾਵਾ ਸਲਵਾਰ ਸੂਟ ਹੈ ਨਾ ਕਿ ਸਾੜੀ ਸਕਲਟ ਜੀਨ ਆਦਿ ਇਹ ਸਾਡੇ ਰਿਵਾਜ਼ ਨਹੀਂ ਹਨ ਇਸ ਕਰਕੇ ਸਾਨੂੰ ਆਪਣੇ ਪਹਿਰਾਵੇ 'ਤੇ ਆਪਣੇ ਸੱਭਿਆਚਾਰ 'ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਸਮੇਂ ਦੇ ਬਦਲਾਵ ਨਾਲ ਵੀ ਸਾਨੂੰ ਆਪਣੇ ਵਿੱਚ ਵੀ ਬਦਲਾਅ ਕਰਨਾ ਚਾਹੀਦਾ ਪਰ ਆਪਣੇ ਸੱਭਿਆਚਾਰ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਸਬ ਸੱਭਿਆਚਾਰ ਹਮੇਸ਼ਾ ਹਮੇਸ਼ਾ ਲਈ ਸਥਿਤ ਹੈ ਔਰ ਰਹੇਗਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਪ੍ਰਭਾਵਿਤ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਸੱਭਿਆਚਾਰ ਨੂੰ ਨਾ ਵਿਸਾਰ ਸਕਣ ਸਾਨੂੰ ਕਦੇ ਵੀ ਕਿਸੇ ਨਾਲ ਨਹੀਂ ਇਹ ਗਲਤ ਭਾਵਨਾ ਨਹੀਂ ਰੱਖਣੀ ਚਾਹੀਦੀ ਅਤੇ ਲੋਕਾਂ ਨੂੰ ਵੀ ਇਹੀ ਚਾਹੀਦਾ ਕਿ ਉਹ ਗੁਰੂ ਘਰ ਸੇਵਾ ਕਰਨ ਅਤੇ ਸਿੱਖ ਦੇ ਇਤਿਹਾਸ ਨੂੰ ਜਾਣੂ ਹੋਣ ਤਾਂ ਜੋ ਆਪਣੇ ਬੱਚਿਆਂ ਨੂੰ ਵੀ ਸਿੱਖ ਬਣਾ ਸਕਣ ਸਾਨੂੰ ਕਦੇ ਵੀ ਆਪਣੀ ਸੱਭਿਆਚਾਰ ਨਹੀਂ ਭੁੱਲਣੀ ਚਾਹੀਦੀ